ਸਾਡੇ ਸਮਾਜ ਵਿੱਚ ਇਸ ਇਸ ਦੁਨੀਆਂ ਦੇ ਵਿੱਚ ਮਾਰਸ਼ਲ ਆਰਟ ਜਿਹੜੀ ਸੱਭਿਆਚਾਰਕਤਾ ਹੈ ਜਾ ਇਹਦਾ ਇਤਿਹਾਸ ਹੈ ਬਹੁਤ ਜ਼ਿਆਦਾ ਖੁਸ਼ੀ ਵਾਲਾ ਨਹੀਂ ਹੈ ਇਹ ਇੱਕ ਇਹੋ ਜਿਹੇ ਮਾਹੌਲ ਦੇ ਵਿੱਚ ਪੈਦਾ ਹੋਇਆ ਹੈ ਜਿਸ ਸਮੇਂ ਕਹਿ ਲਓ ਕਿ ਜਿਹੜੇ ਉਸ ਸਮੇਂ ਦੇ ਭਿਕਸ਼ੂ ਸੀਗੇ ਉਹਨਾਂ ਦਾ ਅੰਤ ਹੋ ਰਿਹਾ ਸੀਗਾ ਜਦੋਂ ਉਹਨਾਂ ਦੇ ਉੱਪਰ ਜੁਲਮ ਢਾਏ ਜਾ ਰਹੇ ਸੀਗੇ ਤਾਂ ਇਹ ਜਿਹੜੇ ਭਿਕਸ਼ੂ ਸੀਗੇ ਇਹਨਾਂ ਨੇ ਦੇਖਿਆ ਵੀ ਕਿ ਸਾਡੇ ਲਾਗੇ ਛਾਗੇ ਸਾਡੇ ਆਂਢ ਗੁਆਂਢ ਸਾਡੇ ਸਾਰਿਆਂ ਪਾਸਿਆਂ ਵਿੱਚ ਜਿਹੜੇ ਜਾਨਵਰ ਨੇ ਉਹ ਬਿਨਾਂ ਕਿਸੇ ਹਥਿਆਰ ਤੋਂ ਬਿਨਾਂ ਕਿਸੇ ਵੈਪਨ ਤੋਂ ਲੜਦੇ ਪਏ ਨੇ ਆਪਣੀ ਸੁਰੱਖਿਆ ਕਰ ਰਹੇ ਨੇ ਇਹ ਸਭ ਕੁਛ ਵੇਖਦੇ ਹੋਏ ਉਹਨਾਂ ਨੇ ਸੋਚਿਆ ਜੇ ਅਸੀਂ ਆਪਣੇ ਹੀ ਬੰਦਿਆਂ ਤੋਂ ਬਚਣਾ ਹੈ ਤਾਂ ਆਪਾਂ ਨੂੰ ਹਥਿਆਰ ਦੀ ਵੀ ਕੋਈ ਇਜਾਜ਼ਤ ਨਹੀਂ ਹੈ ਤਾਂ ਕਿਉਂ ਨਾ ਆਪਾਂ ਵੀ ਕੁਛ ਇੱਦਾਂ ਦਾ ਕਰੀਏ ਕਿ ਆਪਾਂ ਆਪਣੀ ਸੇਫਟੀ ਖੁਦ ਕਰ ਸਕੀਏ ਆਪਣੇ ਆਪ ਨੂੰ ਖੁਦ ਬਚਾ ਸਕੀਏ ਅਤੇ ਇਹਨਾਂ ਨੇ ਰਲ ਮਿਲ ਕੇ ਇੱਕ ਉਪਰਾਲਾ ਕੀਤਾ ਜਿਸ ਤੋਂ ਇਹਨਾਂ ਨੇ ਮਾਰਸ਼ਲ ਆਰਟ ਦੀ ਖੋਜ ਕੀਤੀ ਜਿਹਦੇ ਵਿੱਚ ਇਹ ਆਪਣੇ ਹੱਥ ਆਪਣੇ ਪੈਰ ਨੂੰ ਵਰਤੋਂ ਵਿੱਚ ਲੈ ਕੇ ਆਏ ਅਤੇ ਉਨ੍ਹਾਂ ਤੋਂ ਆਪਣੀ ਮਤਲਬ ਕੀ ਸੁਰੱਖਿਆ ਕਰਨ ਲੱਗ ਪਏ ਦੂਜਿਆਂ ਨੂੰ ਕੁੱਟਣ ਲੱਗ ਪਏ ਮਾਰਨ ਲੱਗ ਪਏ ਅਤੇ ਇਸ ਤਰੀਕੇ ਨਾਲ ਇੱਕ ਮਾਰਸ਼ਲ ਆਰਟ ਦਾ ਕਹਿ ਲਓ ਕਿ ਜਨਮ ਹੋਇਆ ਜਿਹਦੇ ਵਿੱਚ ਸਾਡਾ ਜਿਹੜਾ ਜਨਮ ਜਾ ਜਨਮ ਦਾਤਾ ਹੈ ਉਹ ਸਾਡਾ ਦੇਸ਼ ਹੈ ਸਾਡਾ ਭਾਰਤ ਹੈ ਭਾਰਤ ਤੋਂ ਇਹ ਮਾਰਸ਼ਲ ਆਰਟ ਦੀ ਸ਼ੁਰੂਆਤ ਹੋਈ ਬਾਅਦ ਦੇ ਵਿੱਚੋਂ ਜਦੋਂ ਸਾਡੇ ਦੇਸ਼ ਵਿੱਚ ਇੱਦਾਂ ਦਾ ਅਪਾਤਕਾਲੀਨ ਵਕਤ ਆ ਗਿਆ ਕਿ ਇੱਥੋਂ ਸਾਡੇ ਜਿਹੜੇ ਬੰਦੇ ਸੀ ਉਹਨਾਂ ਨੂੰ ਭੱਜਣਾ ਪਿਆ ਜਿਸ ਕਰਕੇ ਜਦੋਂ ਇੱਥੋਂ ਭੱਜੇ ਅਤੇ ਵੱਖਰੇ ਵੱਖਰੇ ਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਗਏ ਕਈ ਲੋਕ ਜਾਪਾਨ ਚੱਲ ਗਏ ਕੋਈ ਚਾਈਨਾ ਚੱਲ ਗਏ ਕੋਈ ਕੋਰੀਆ ਚੱਲ ਗਏ ਕੋਈ ਅਮਰੀਕਾ ਚੱਲ ਗਏ ਅਤੇ ਹੌਲੀ ਹੌਲੀ ਉਹਨਾਂ ਨੇ ਉੱਥੇ ਜਾ ਕੇ ਆਪਣਾ ਕਾਰੋਬਾਰ ਆਪਣਾ ਇਹ ਜਿਹੜਾ ਸੀਗਾ ਮਾਰਸ਼ਲ ਆਰਟ ਦਾ ਯੁੱਗ ਸੀਗਾ ਉਹਨਾਂ ਨੂੰ ਉੱਥੋਂ ਪੈਦਾ ਕੀਤਾ ਅਤੇ ਅੱਜ ਸਮੇਂ ਵਿੱਚ ਸਾਡੇ ਲਈ ਇੱਕ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਨੌਜਵਾਨਾਂ ਬੱਚਿਆਂ ਨੂੰ ਸਾਡੇ ਜਿਹੜੇ ਪੀੜ੍ਹੀ ਹੈ ਛੋਟੇ ਬੱਚਿਆਂ ਦੀ ਉਹਨਾਂ ਨੂੰ ਜਾਂ ਉਹਨਾਂ ਦੇ ਮਾਪਿਆਂ ਨੂੰ ਵੀ ਨਹੀਂ ਪਤਾ ਕਿ ਮਾਰਸ਼ਲ ਆਰਟ ਦਾ ਜਨਮਦਾਤਾ ਕੌਣ ਹੈ ਮਾਰਸ਼ਲ ਆਰਟ ਕਿਹੜੇ ਦੇਸ਼ ਦੇ ਵਿੱਚ ਸ਼ੁਰੂ ਹੋਇਆ ਇਹ ਕਿਵੇਂ ਸ਼ੁਰੂ ਹੋਇਆ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਹੀ ਉਸ ਮਾਰਸ਼ਲ ਆਰਟ ਦੇ ਜਨਮਦਾਤਾ ਹਾਂ ਉਸ ਭਾਰਤ ਦੇ ਇਨਸਾਨ ਨੇ ਹੀ ਜਿਹਨਾਂ ਨੇ ਮਾਰਸ਼ਲ ਆਰਟ ਦੀ ਖੋਜ ਕੀਤੀ ਹੈ ਅਤੇ ਇਹ ਮਾਰਸ਼ਲ ਆਰਟ ਦਾ ਹੁਣ ਅੱਜ ਦੇ ਸਮੇਂ ਵਿੱਚ ਬਹੁਤ ਵੱਡਾ ਹੱਥ ਹੈ ਸਾਨੂੰ ਤੰਦਰੁਸਤ ਰੱਖਣ ਨੂੰ ਸਾਨੂੰ ਮਤਲਬ ਸੇਫ ਰੱਖਣ ਲਈ ਅਤੇ ਇਹ ਸਾਡੇ ਜ਼ਿੰਦਗੀ ਵਿੱਚ ਵੀ ਇੱਕ ਬਹੁਤ ਵੱਡਾ ਹਿੱਸਾ ਬਣ ਚੁੱਕਾ ਹੈ ਅਤੇ ਮਾਰਸ਼ਲ ਆਰਟ ਦਾ ਹਰ ਵੇਲੇ ਅਸੀਂ ਇਹ ਕਹਿ ਲਓ ਕਿ ਸਿੱਖਦੇ ਹਾਂ ਉਹੀ ਚੀਜ਼ ਵਰਤਦੇ ਹਾਂ ਇਸ ਲਈ ਮਾਰਸ਼ਲ ਆਰਟ ਬਹੁਤ ਹੀ ਫੈਲੀ ਹੋਈ ਇੱਕ ਪਰੰਪਰਾ ਬਣ ਚੁੱਕੀ ਹੈ ਸਾਡੇ ਦੇਸ਼ ਦੇ ਵਿੱਚ ਪੂਰੀ ਦੁਨੀਆਂ ਦੇ ਵਿੱਚ